ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਹੀ ਜ਼ਿਆਦਾ ਮਹੱਤਵ ਹੈ ਕਿਉਂਕਿ ਭੰਗੜਾ ਜਿਹੜਾ ਆ ਹਰ ਇੱਕ ਪੰਜਾਬੀ ਜਿਹੜਾ ਆ ਪਾਉਣਾ ਜਾਣਦਾ ਹੈ ਉਹ ਹਰ ਇੱਕ ਤਿਉਹਾਰ ਵਿੱਚ ਹਰ ਇੱਕ ਤਿਉਹਾਰ ਦੇ ਮੌਕੇ ਅਤੇ ਖੁਸ਼ੀ ਦੇ ਮੌਕੇ 'ਤੇ ਜਿਹੜੇ ਆ ਭੰਗੜਾ ਪਾ ਕੇ ਆਪਣੀ ਖੁਸ਼ੀ ਜਿਹੜਾ ਆ ਪ੍ਰਗਟਾਉਂਦੇ ਹਨ ਭੰਗੜਾ ਹਰ ਪੰਜਾਬੀ ਹਰ ਹਿੰਦੂ ਜਿਹੜਾ ਆ ਉਹ ਜਾਣਦਾ ਹੈ ਅਤੇ ਉਹ ਹਰ ਖੁਸ਼ੀ ਦੇ ਮੌਕੇ 'ਤੇ ਜਿਹੜਾ ਆ ਉਹ ਇਹਨੂੰ ਭੰਗੜੇ ਦੇ ਰਾਹੀਂ ਆਪਣਾ ਜਿਹੜਾ ਆ ਜੋਸ਼ ਪ੍ਰਗਟ ਕਰਦੇ ਹਨ ਆਪਣਾ ਉਤਸ਼ਾਹ ਪ੍ਰਗਟ ਕਰਦੇ ਹਨ ਕਿ ਉਹ ਕਿੰਨੇ ਹੀ ਜ਼ਿਆਦਾ ਇਸ ਤਿਉਹਾਰ ਵਿੱਚ ਦਿਲਚਸਪੀ ਰੱਖਦੇ ਹਨ ਸਮੇਂ ਦੇ ਨਾਲ ਨਾਲ ਇਹ ਤਿਉਹਾਰ ਜਿਹੜਾ ਏ ਇੱਕ ਮਹੱਤਵਪੂਰਨ ਹਿੱਸਾ ਜਿਹੜਾ ਹੈ ਪੰਜਾਬ ਦਾ ਬਣ ਗਿਆ ਕਿਉਂਕਿ ਤਿਉਹਾਰਾਂ ਵਿੱਚ ਵੱਧ ਤੋਂ ਵੱਧ ਜਿਹੜੇ ਆ ਉਹ ਜਿਹੜੇ ਆ ਲੋਕ ਨਾਚ ਕਿਉਂਕਿ ਭੰਗੜਾ ਇੱਕ ਲੋਕ ਨਾਚ ਹੈ ਅਤੇ ਇਹ ਲੋਕ ਨਾਚ ਲੋਕ ਨਾਚ ਵਜੋਂ ਹੀ ਪੰਜਾਬੀਆਂ ਦੁਆਰਾ ਹਰ ਤਿਉਹਾਰ ਵਿੱਚ ਪਾਇਆ ਜਾਂਦਾ ਹੈ ਇਸ ਕਾਰਨ ਇਹ ਸਮੇਂ ਦੇ ਨਾਲ ਨਾਲ ਜਿਹੜਾ ਇਹ ਤਿਉਹਾਰਾਂ ਦਾ ਵੀ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਅਤੇ ਇਸ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਜਿਹੜੀ ਆ ਬਹੁਤ ਹੀ ਜ਼ਿਆਦਾ ਮਹੱਤਵ ਹੈ ਅਤੇ ਅੱਜ ਹਰ ਇੱਕ ਪੰਜਾਬੀ ਜਿਹੜਾ ਹੈ ਜ਼ਿਆਦਾ ਭੰਗੜੇ ਨੂੰ ਉਹਦੀ ਉਤਸਾਹ ਦਿੰਦਾ ਅਤੇ ਉਹ ਭੰਗੜਾ ਪਾਉਣਾ ਬਾਖੂਬੀ ਜਾਣਦਾ ਹੈ